ਸਤਿ ਸ਼੍ਰੀ ਅਕਾਲ ਜੀ ਚੰਦਨ ਰੈਸਟੋਰੈਂਟ ਤੋਂ ਬੋਲ ਰਹੇ ਹੋ ਠੀਕ ਹੋ ਮੈਂ ਨਾ ਇੱਕ ਆਰਡਰ ਕੀਤਾ ਸੀ ਵੈਸੇ ਤੁਹਾਨੂੰ ਪਤਾ ਹੈ ਪਰ ਫਿਰ ਵੀ ਇੱਕ ਵਾਰ ਮੈਚ ਕਰ ਲਓ ਇੱਕ ਹਾਫ ਪਲੇਟ ਨਿਊਡਲ ਇੱਕ ਫੁੱਲ ਪਲੇਟ ਡਰਾਈ ਮੋਮਸ ਇੱਕ ਫੁਲ ਪਲੇਟ ਗਰੇਵੀ ਮੰਚੁਰੀਅਨ ਨੂੰ ਦੋ ਕੋਲਡ ਡਰਿੰਕ ਇੱਕ ਬਨਾਨਾ ਸੇਕ ਇੱਕ ਪੀਜਾ ਅਤੇ ਨਾਲ ਸੋਸ ਉਹ ਵੱਧ ਭੇਜ ਦਿਓ ਨਾਲ ਨੈਪਕਿਨ ਕਿਉਂਕਿ ਇਹ ਮੈਂ ਦੁਬਾਰਾ ਤਾਂ ਆਰਡਰ ਕਰ ਰਿਹਾ ਪਹਿਲਾਂ ਬਹੁਤ ਵਧੀਆ ਸੀ ਅਤੇ ਬੜੇ ਹੀ ਟਾਈਮ 'ਤੇ ਆਇਆ ਸੀ ਇਸ ਕਰਕੇ ਮੈਨੂੰ ਬਹੁਤ ਵਧੀਆ ਲੱਗਿਆ ਤਾਂ ਉਸ ਕਰਕੇ ਮੈਂ ਇਹਨੂੰ ਦੁਬਾਰਾ ਆਰਡਰ ਕੀਤਾ ਬੜੇ ਹੀ ਟਾਈਮ 'ਤੇ ਆਇਆ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ